ਪਾਣੀ ਸਾਡੇ ਜੀਵਨ ਲਈ ਬਹੁਤ ਅਹਿਮ ਭੂਮਿਕਾ ਬਣ ਚੁੱਕੀ ਹੈ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਜਿਵੇਂ ਕਿ ਪਾਣੀ ਸਾਨੂੰ ਕੱਪੜੇ ਧੋਣ ਦੇ ਵਿੱਚ ਕੰਮ ਆਉਂਦਾ ਭਾਂਡੇ ਧੋਣ ਦੇ ਵਿੱਚ ਆਦਿ ਹੋਰ ਵੀ ਬਹੁਤ ਚੀਜ਼ਾਂ ਦੇ ਵਿੱਚ ਸਾਨੂੰ ਪਾਣੀ ਦੀ ਵਰਤੋਂ ਹੁੰਦੀ ਹੈ ਪਾਣੀ ਆਪਾਂ ਹਰ ਕੰਮ ਦੇ ਵਿੱਚ ਵਰਤੋਂ ਲੈਂਦੇ ਹਾਂ ਪਾਣੀ ਦੇ ਬਿਨਾ ਦੁਨੀਆ ਦੇ ਵਿੱਚ ਆਪਣਾ ਰਹਿਣਾ ਬਹੁਤ ਔਖਾ ਹੋ ਚੁੱਕਿਆ ਹੈ ਪਾਣੀ ਪਹਿਲਾਂ ਜ਼ਮਾਨੇ ਦੇ ਵਿੱਚ ਪਾਣੀ ਨਾਲ ਲੋ ਔਰਤਾਂ ਦੂਰ ਜਾ ਕੇ ਕੂਏ ਦੇ ਵਿੱਚ ਜਾ ਕੇ ਪਾਣੀ ਲੈ ਕੇ ਆਉਂਦੀਆਂ ਸੀ ਅਤੇ ਕੱਪੜੇ ਧੋਂਦੀਆਂ ਸੀ ਪਰ ਘਰ ਪਰ ਘਰਾਂ ਦੇ ਵਿੱਚ ਜ਼ਿਆਦਾ ਜ਼ਿਆਦਾ ਮੈਂਬਰ ਹੋਣ ਕਰਕੇ ਔਰਤਾਂ ਕੱਪੜਿਆਂ ਨੂੰ ਗੱਠੜੀ ਦੇ ਵਿੱਚ ਬੰਨ੍ਹ ਕੇ ਲੈ ਕੇ ਖੂਹਿਆ ਦੇ ਵਿੱਚ ਲੈ ਕੇ ਜਾਂਦੀਆਂ ਅਤੇ ਉੱਥੇ ਜਾ ਕੇ ਧੋ ਲੈਂਦੀਆਂ ਹਫਤੇ 'ਚ ਇੱਕ ਹਫਤੇ 'ਚ ਇੱਕ ਵਾਰੀ ਹੀ ਧੋਂਦੀਆਂ ਸਨ ਹਫਤੇ 'ਚ ਇੱਕ ਵਾਰੀ ਧੋਂਦੀਆਂ ਸਨ ਕਿਉਂਕਿ ਉਹਨਾਂ ਤੋਂ ਦੋ ਦੋ ਵਾਰੀ ਧੋਤਾ ਨਹੀਂ ਜਾਂਦੀਆਂ ਸਨ ਕਿਉਂਕਿ ਜ਼ਿਆਦਾ ਪਰੇਸ਼ਾਨੀ ਹੁੰਦੀ ਸੀ ਇਹਨਾਂ ਦੇ ਬਹੁਤ ਨੁਕਸਾਨ ਹੁੰਦੇ ਹਨ ਜਿਵੇਂ ਕਿ ਬਹੁਤ ਆਦਿ ਨੁਕਸਾਨ ਹੁੰਦੇ ਹਨ ਜਿਵੇਂ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੁੰਦੀਆਂ ਸੀ ਵੀ ਕੱਪੜੇ ਧੋਣ ਨਾਲ ਇੰਨੇ ਗੱਠੜੇ ਭਰ ਕੇ ਕੂਏ ਤਿੱਕਰ ਲੈ ਕੇ ਜਾਣਾ ਅਤੇ ਫਿਰ ਉਸਨੂੰ ਵਾਪਸ ਲੈ ਕੇ ਆਉਣਾ ਇਹ ਚੀਜ਼ਾਂ ਨਹੀਂ ਸਹੀ ਹੁੰਦੀਆਂ ਸੀ ਪਰ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਸਰਕਾਰ ਨੇ ਇੰਨੀ ਹੀ ਤਰੱਕੀ ਕਰ ਚੁੱਕੇ ਹਨ ਉਹਨਾਂ ਨੇ ਘਰਾਂ ਦੇ ਵਿੱਚ ਪਾਈਪਲਾਈਨ ਪ੍ਰਤੀ ਪਾਣੀ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਵਿਗਿਆਨ ਨੇ ਵੀ ਬਹੁਤ ਤਰੱਕੀ ਕਰ ਲਈ ਹੈ ਉਹਨਾਂ ਨੇ ਵੀ ਵਾਸ਼ਿੰਗ ਮਸ਼ੀਨਾਂ ਆਟੋਮੈਟਿਕ ਵਾਸ਼ਿੰਗ ਮਸ਼ੀਨਾਂ ਆਦਿ ਬਣਾ ਦਿੱਤੀਆਂ ਹਨ ਪਹਿਲੇ ਜ਼ਮਾਨੇ ਦੇ ਵਿੱਚ ਲੋਕ ਔਰਤਾਂ ਮਿੱਟੀ ਨਾਲ ਧੋਂਦੀਆਂ ਸੀ ਕੱਪੜੇ ਪਰ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਡਿਟਰਜੈਂਟ ਬਣ ਚੁੱਕੇ ਹਨ ਮਸ਼ ਮਸ਼ੀਨਾਂ ਦਾ ਬਹੁਤ ਪ੍ਰਯੋਗ ਕਰਦੀ ਹੈ ਦੁਨੀਆ ਪਰ ਕੁਝ ਲੋਕ ਉਸਨੂੰ ਖਰੀਦ ਨਹੀਂ ਸਕਦੇ ਆਪਦੀ ਆਰਥਿਕ ਤੰਗੀ ਕਰਕੇ ਪਰ ਇਸ ਕਰਕੇ ਉਹਨਾਂ ਨੂੰ ਬਹੁਤ ਪਰੇਸ਼ਾਨੀਆਂ ਆਉਂਦੀਆਂ ਹਨ ਜਿਵੇਂ ਕਿ ਮੌਸਮ ਖਰਾਬ ਹੋਣਾ ਮੌਸਮ ਜਿਵੇਂ ਖਰਾਬ ਹੁੰਦਾ ਉਹਨਾਂ ਨੂੰ ਇਹ ਦਿੱਕਤ ਆਉਂਦੀ ਹੈ ਵੀ ਉਹ ਮੌਸਮ ਖਰਾਬ ਹੁੰਦਾ ਕੱਪੜੇ ਸੁੱਕਣੇ ਪਾਉਂਦੀਆਂ ਜੇ ਐਟ ਏ ਟਾਈਮ ਉਸ ਸਮੇਂ ਕਿਤੇ ਵੀ ਜਾਣਾ ਪੈ ਜਾਵੇ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਵੀ ਉਹ ਕੱਪੜੇ ਨਹੀਂ ਸੁਕਾ ਸਕਦੀਆਂ ਟਾਈਮ ਟੂ ਟਾਈਮ ਜੇ ਕੋਈ ਬੱਚੇ ਨੇ ਸਕੂਲ ਜਾਣਾ ਹੋਵੇ ਉਹਦੀ ਵਰਦੀ ਧੁੱਪੀ ਹੋਵੇ ਅਤੇ ਲਾਈਟ ਚਲੀ ਕਰਕੇ ਡਰਾਈਰ ਨਹੀਂ ਕਰ ਪਾਉਂਦੇ ਅਤੇ ਉਹਨਾਂ ਨੂੰ ਸੁਕਾਉਣੇ ਸੌਖੇ ਹੁੰਦੇ ਆ ਪੱਖਿਆਂ ਤਾਂ ਨਹੀਂ ਉਹ ਸੁਕਾਉਂਦੇ ਆ ਜਿਸ ਕਰਕੇ ਉਹ ਥੋੜ੍ਹੀ ਸਿੱਲ੍ਹੀ ਸਿੱਲ੍ਹੀ ਰਹਿ ਜਾਂਦੀ ਹੈ ਅਤੇ ਜਿਸ ਕਰਕੇ ਬਹੁਤ ਪਰੇਸ਼ਾਨੀਆਂ ਆਉਂਦੀਆਂ ਹਨ ਪਰ ਵਿਗਿਆਨ ਨੇ ਵਾਸ਼ਿੰਗ ਮਸ਼ੀਨ ਇਹੋ ਜਿਹੀ ਆਟੋਮੈਟਿਕ ਬਣਾ ਦਿੱਤੀ ਹੈ ਜਿਵੇਂ ਕਿ ਉਹਦੇ ਵਿੱਚ ਕੱਪੜੇ ਪਾਣੀ ਪਾਓ ਕੱਪੜੇ ਵਿੱਚ ਕੱਪੜੇ ਧੋਵੋ ਅਤੇ ਡਰਾਈਰ ਕਰ ਦਿਉ ਵਿੱਚੋਂ ਸੁੱਕੇ ਹੋਏ ਕੱਪੜੇ ਨਿਕਲਣਗੇ ਪਰ ਹਰ ਕੋਈ ਇਸ ਚੀਜ਼ ਨੂੰ ਖਰੀਦ ਨਹੀਂ ਸਕਦਾ ਇਹ ਬਹੁਤ ਮਹਿੰਗੀਆਂ ਹੁੰਦੀਆਂ ਹਨ ਅਤੇ ਸਾਬਣ ਪ੍ਰਤੀ ਵੀ ਹੋਰ ਡਿਟਰਜੈਂਟ ਬਣ ਚੁੱਕੇ ਹਨ ਜਿਸ ਕਰਕੇ ਔਰਤਾਂ ਨੂੰ ਬਹੁਤ ਜਿਵੇਂ ਸ਼ੈ ਪਹਿਲਾਂ ਤਾਂ ਲੋਕ ਰੇਤੇ ਨਾਲ ਧੋਂਦੇ ਸੀ ਜਿਸਦੇ ਜਿਸ ਕਰਕੇ ਦਾਗ ਦੂਗ ਨਹੀਂ ਮਿਟਦੇ ਸੀ ਚੰਗੀ ਤਰ੍ਹਾਂ ਅਤੇ ਕੱਪੜਿਆਂ ਨੂੰ ਇੰਨੀ ਚਿਕਨਾਈ ਨਹੀਂ ਆਉਂਦੀ ਸੀ ਸਾਫ ਸੁਫ ਨਹੀਂ ਹੁੰਦੇ ਸੀ ਪਰ ਅੱਜ ਕੱਲ੍ਹ ਦੇ ਵਿੱਚ ਡਿਟਰਜੰਟ ਬਣ ਚੁੱਕੇ ਹਨ ਆਦਿ ਡਿਟਰਜੰਟ ਬਹੁਤ ਤਰ੍ਹਾਂ ਦੇ ਇਹੋ ਜਿਹੇ ਕੈਮੀਕਲ ਸ਼ੈਮਪੂ ਜਾਂ ਕੁਛ ਵੀ ਆਦਿ ਬਣ ਚੁੱਕੇ ਹਨ ਜੋ ਕਿ ਕੱਪੜਿਆਂ ਨੂੰ ਖੁਸ਼ਬੂਦਾਰ ਅਤੇ ਸਾਫ ਸੁਥਰਾ ਕਰਦਾ ਹੈ ਇਹ ਸਾਡੇ ਲਈ ਬਹੁਤ ਵਧੀਆ ਚੀਜ਼ਾਂ ਬਣ ਚੁੱਕੀਆਂ ਹਨ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ ਮਸ਼ੀਨਾਂ ਆਦਿ ਬਣਾ ਬਣਾਉਣ ਦੇ ਵਿੱਚ ਧੰਨਵਾਦ